ਵੈਸੇ ਤਾਂ ਅਸੀਂ ਸਾਰੇ ਧਰਮਾਂ ਦਾ ਪਾਲਣਾ ਕਰਦੇ ਹਾਂ ਮੈਂ ਹਿੰਦੂ ਫੈਮਲੀ ਤੋਂ ਬਿਲੌਂਗ ਕਰਦਾ ਹਾਂ ਅਸੀਂ ਕ੍ਰਿਸ਼ਨ ਜੀ ਦੀ ਫੋਟੋ 'ਤੇ ਫੋਟੋ ਨੂੰ ਪੂਜਦੇ ਹਾਂ ਅਤੇ ਉਹਨਾਂ ਦੀ ਫੋਟੋ 'ਤੇ ਮੱਖਣ ਚੜਾਉਂਦੇ ਹਾਂ ਉਸ ਤੋਂ ਇਲਾਵਾ ਅਸੀਂ ਸ਼ਿਵਲਿੰਗ 'ਤੇ ਦੁੱਧ ਚੜਾਉਂਦੇ ਹਾਂ ਸ਼ਿਵ ਭੋਲੇ ਦੀ ਪੂਜਾ ਕਰਦੇ ਹਾਂ ਅਸੀਂ ਕਾਲੀ ਮਾਤਾ ਦੇ ਨਰਾਤੇ ਵਗੈਰਾ ਜੋਤ ਵਗੈਰਾ ਜਗਾਉਂਦੇ ਹਾਂ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਾਂ ਇਸ ਤੋਂ ਇਲਾਵਾ ਅਸੀਂ ਨੈਣਾ ਦੇਵੀ ਵੀ ਜਾਂਦੇ ਹਾਂ ਉੱਥੇ ਜਾ ਕੇ ਅਸੀਂ ਮੱਥਾ ਟੇਕਦੇ ਹਾਂ ਗੁਰਦੁਆਰਾ ਜਾ ਕੇ ਮੱਥਾ ਵੀ ਟੇਕਦੇ ਹਾਂ ਅਤੇ ਲੰਗਰ ਪਾਣੀ ਵੀ ਛੱਕਦੇ ਹਾਂ